ਹੈਲੋ ਹਾਂਜੀ ਤੁਸੀਂ ਫਰਨੀਚਰ ਵਾਲੀ ਦੁਕਾਨ ਤੋਂ ਬੋਲਦੇ ਹੋ ਅਤੇ ਫਰਨੀਚਰ ਬਣਵਾਉਣਾ ਸੀਗਾ ਘਰ ਵਾਸਤੇ ਜੀ ਜਿਵੇਂ ਸੋਫੇ ਡਾਈਨਿੰਗ ਟੇਬਲ ਅਤੇ ਜਿਵੇਂ ਡਰੈਸਿੰਗ ਟੇਬਲ ਬੈੱਡ ਜੀ ਤਕਰੀਬਨ ਸਾਰਾ ਹੀ ਨਵਾਂ ਤਿਆਰ ਕਰਵਾਉਣਾ ਹਾਂਜੀ ਹਾਂਜੀ ਸੋਫੇ ਵੀ ਵਧੀਆ ਮਿਲ ਜਾਣਗੇ ਬਣਾ ਦਿੰਦੇ ਹੋ ਅੱਛਾ ਅੱਛਾ ਅੱਛਾ ਮੇਜ਼ ਜਿਹੜਾ ਨਾਲ ਸੋਫੇ ਦੇ ਤਿਆਰ ਕਰੋਗੇ ਸੇਮ ਹੀ ਕਰੋਗੇ ਕਿ ਅੱਛਾ ਅੱਛਾ ਅੱਛਾ ਅੱਛਾ ਅੱਛਾ ਅਤੇ ਵਧੀਆ ਹੋਣਾ ਚਾਹੀਦਾ ਵੀ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਅੱਛਾ ਅੱਛਾ ਜਿਵੇਂ ਨਾ ਕਮਰੇ ਦੇ ਵਿੱਚ ਰੱਖਣ ਨੂੰ ਵੀ ਜਿਵੇਂ ਦੋ ਕੁਰਸੀਆਂ ਅਲੱਗ ਹੋਣ ਅਤੇ ਹਾਂਜੀ ਅਤੇ ਇੱਕ ਬੈੱਡ ਵੀ ਵਧੀਆ ਹੋਣਾ ਚਾਹੀਦਾ ਵੀ ਜਿਵੇਂ ਪੂਰੀ ਕੰਧ ਵੀ ਡੈਕੋਰੇਟ ਹੋਣੀ ਚਾਹੀਦੀ ਹੈ ਬਈ ਵੀ ਐਂਉਂ ਵਧੀਆ ਲੱਗਣਾ ਚਾਹੀਦਾ ਅੱਛਾ ਅਤੇ ਬੈੱਡ ਤੁਸੀਂ ਸਾਗਵਾਨ ਦੀ ਲੱਕੜ ਦਾ ਬਣਾਉਂਦੇ ਆ ਬੈੱਡ ਜਾਂ ਟਾਲੀ ਦਾ ਅੱਛਾ ਵਧੀਆ ਕਿਹੜਾ ਵਧੀਆ ਕਿਹੜਾ ਹੁੰਦਾ ਵੀ ਜਿਹੜਾ ਜਿਹਨੂੰ ਸਿਉਂਕ ਨਾ ਪਵੇ ਲੱਕੜ ਅੱਛਾ ਅੱਛਾ ਅੱਛਾ ਅੱਛਾ ਅਤੇ ਅਸੀਂ ਰਸੋਈ ਵੀ ਤਿਆਰ ਕਰਾਉਣੀ ਹੈ ਵਧੀਆ ਅੱਛਾ ਜਿਵੇਂ ਅੱਜ ਕੱਲ੍ਹ ਚੱਲਦੀਆਂ ਰਸੋਈਆਂ ਹੂੰ ਵਧੀਆ ਕਪ ਵਿੱਚ ਬਣਾਉਣੇ ਹੈ ਰੈਕ ਵਗੈਰਾ ਸਾਰਾ ਕੁਛ ਅੱਛਾ ਅੱਛਾ ਅੱਛ ਅੱਛਾ ਚਲੋ ਇਹ ਤਾਂ ਹੋ ਗਿਆ ਰਸੋਈ ਅਤੇ ਹੋਰ ਜਿਵੇਂ ਸੋਫਾ

ਚਲੋ ਠੀਕ ਹੈ ਫੇਰ ਅਸੀਂ ਆ ਕੇ ਆ ਕੇ ਅਸੀਂ ਡਿਜਾਈਨ ਦੇਖ ਕੇ ਜਾਵਾਂਗੇ ਠੀਕ ਹੈ ਫੇਰ